ਹੈਲੋ ਸਤਿ ਸ਼੍ਰੀ ਅਕਾਲ ਸਰ ਤੁਸੀਂ ਮਜ਼ੀਸਨ ਬੋਲ ਰਹੇ ਹੋ ਸਰ ਮੈਂ ਨਾ ਅਸਲ ਦੇ ਵਿੱਚ ਮੇਰਾ ਨਾਮ ਮਨਿੰਦਰ ਆ ਅਤੇ ਮੈਨੂੰ ਨਵਾਂ ਨਵਾਂ ਗਾਉਣ ਦਾ ਚਾਅ 'ਚ ਚਸਕਾ ਵਾ ਅਤੇ ਨਾ ਮੈਂ ਸਟਾਰਟ ਕਰਨਾ ਸੀਗਾ ਅਤੇ ਮੈਨੂੰ ਮਿਊਜ਼ੀਕਲ ਇੰਡਸਟਰੀ ਦੇ ਵਿੱਚ ਜਾਣਾ ਚਾਹੁੰਦਾ ਸੀਗਾ ਅਤੇ ਮੈਨੂੰ ਤੁਸੀਂ ਗਾਈਡ ਕਰ ਸਕਦੇ ਹੋ ਕਿ ਕਿੱਦਾਂ ਆ ਸਕੀਏ ਮੈਂ ਜਿੱਦਾਂ ਪਹਿਲਾਂ ਪੰਜਾਬੀ ਸਿੰਗਰ ਨਹੀਂ ਗਾਉਂਦੇ ਹੁੰਦੇ ਸੀਗੇ ਥੋੜ੍ਹਾ ਲੋਅ ਪਿੱਚ 'ਤੇ ਲੋਅ ਬੇਸ 'ਤੇ ਓਲਡ ਸਟਾਈਲ ਓਲਡ ਸਟਾਈਲ ਪੰਜਾਬੀ ਸਿੰਗਿੰਗ ਹਾਂਜੀ ਮੈਂ ਨਵਾਂ ਸਟਾਰਟ ਕਰਨਾ ਜੀ ਨਹੀਂ ਸਰ ਨਹੀਂ ਨਹੀਂ ਕੋਈ ਇੰਸਟਰੂਮੈਂਟ ਨਹੀਂ ਅੱਛਾ ਜੀ ਨਹੀਂ ਮੇਰੀ ਨਹੀਂ ਨਹੀਂ ਸਰ ਮੈਨੂੰ ਤਾਂ ਇੰਨਾਂ ਕੋਈ ਹੈ ਨਹੀਂ ਗਾ ਇਨਫੋਰਮੇਸ਼ਨ ਵਗੈਰਾ ਵੀ ਨੇੜੇ ਤੇੜੇ ਕੋਈ ਹੋਵੇ ਮੈਂ ਲੁਧਿਆਣੇ

ਨਹੀਂ ਮੈਂ ਸ਼ਿਮਲਾਪੁਰੀ ਹਾਂਜੀ ਹਾਂਜੀ ਹਾਂਜੀ ਦੁੱਗਰੀ ਨੇੜੇ ਆ ਨਹੀਂ ਨਹੀਂ ਕੋਈ ਕਿਹੜੀ ਰੇਂਜ ਕਿਹੜੀ ਹੁੰਦੀ ਆ ਵੀ ਜਿਦਾਂ ਵਧੀਆ ਜਿਹਾ ਕੋਈ ਹੋਵੇ ਹੈ ਨਾ ਵੀ ਜਲਦੀ ਲੋਂਗ ਲਾਈਫ ਕੱਢਦੇ ਫਾਈਵ ਥਾਊਂਜੈਂਟ ਦੇ ਵਿੱਚ ਅਤੇ ਬੈਟਰ ਪਰਫੋਰਮੈਂਸ ਮਤਲਬ ਲੋਂਗ ਲਾਈਫ ਕਿਹੜਾ ਕੱਢ ਸਕਦੇ ਅੱਛਾ ਜੀ ਚਲੋ ਜੇ ਫਿਰ ਆਪਾਂ ਲੈ ਵੀ ਲੈਂਦੇ ਹਾਂ ਫਿਰ ਉਸ ਤੋਂ ਬਾਅਦ ਅਗਲੇ ਨੀਸ਼ਅਲੀ ਸਟੈਪ ਕੀ ਹੋਏਗਾ ਉਹਦਾ ਸਟੈਪ ਹਮ ਹਮ ਹਾਂ ਮੁਹੰਮਦ ਸਦੀਕ ਹੋ ਗਏ ਹਾਂਜੀ ਉਹਨਾਂ ਅੱਗੇ ਜਾਂ ਮਾਣਕ ਹੋਗੇ ਮਾਣਕ ਹੋ ਗਏ ਉਹਨਾਂ ਦੇ ਅੱਛਾ ਜੀ ਅਤੇ ਉਹਨੂੰ ਕਿੰਨਾ ਕੁ ਟਾਈਮ ਲੱਗੇਗਾ ਉਹਨਾਂ ਨੂੰ ਸਿੱਖਣ 'ਚ ਅਤੇ ਜਿਵੇਂ ਰੈਗੂਲਰ ਰੂਟੀਨ ਦੇ ਵਿੱਚ ਕਰਾਂ ਅਤੇ ਦਿਨ ਦਾ ਕਿੰਨਾ ਕੁ ਮੈਨੂੰ ਟਾਈਮ ਡਿਪੋਰਟ ਕਰਨਾ ਪਏਗਾ ਇਹ ਚੀਜ਼ ਨੂੰ ਅੱਛਾ ਜੀ ਅਤੇ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਸਰ ਇਹਦਾ ਕਿੰਨਾ ਕੋਰਸ ਮਤਲਬ ਮੈਕਸੀਮਮ ਟਾਈਮ ਬੈਸਟ ਕਰਨ ਨੂੰ ਸਰਗਮ ਦੇ ਵਿੱਚ ਕਿੰਨਾ ਕੁ ਲੱਗ ਜੇਗਾ ਐਸਟੀਮੇਟ ਕੋਈ ਹਾਂਜੀ ਠੀਕ ਹੈ ਜੀ ਅਤੇ ਹਾਰਮੋਨੀਅਮ ਤੋਂ ਬਾਅਦ ਅਗਲਾ ਸਟੈਪ ਕੀ ਹੋਵੇਗਾ ਜੇ ਆਪਾਂ ਹਾਰਮੋਨੀਅਮ ਬੈਸਟ ਬਜਾਣਾ ਸ਼ੁਰੂ ਕਰਤਾ ਹੈ ਨਾ ਪਲੇ ਕਰਨਾ ਸ਼ੁਰੂ ਕਰਤਾ ਅਤੇ ਉਸ ਤੋਂ ਬਾਅਦ ਅਗਲਾ ਸਟੈਪ ਹਮ ਹਮ ਠੀਕ ਹੈ ਜੀ ਅਤੇ ਤੁਹਾਡਾ ਮੈਨੂੰ ਕੰਟੈਕਟ ਨੰਬਰ ਮੈਂ ਈਮੇਲ ਆਈਡੀ ਮਿਲ ਸਕਦੀ ਮੈਂ ਤੁਹਾਨੂੰ ਆਪਣਾ ਇੱਕ ਵਾਰੀ ਰਿਕਾਰਡ ਕਰਕੇ ਆਪਣੀ ਆਵਾਜ਼ ਭੇ ਸੈਂਡ ਕਰ ਦਾਂਗਾ ਹੈ ਨਾ ਅਤੇ ਤੁਸੀਂ ਇੱਕ ਵਾਰੀ ਇਵੈਲੂਏਟ ਕਰ ਲਿਓ ਵੀ ਹੈ ਨਾ ਅਤੇ ਮੈਨੂੰ ਗਾਈਡੈਂਸ ਦੇ ਦਿਓ ਨਹੀਂ ਨਹੀਂ ਔਫਲਾਈਨ ਪ੍ਰੈਕਟਿਸ ਹੋ ਜਾਏਗੀ

ਗਿੱਲ ਚੌਂਕ ਕਿੱਥੇ ਕ ਗਲੀ ਨੰਬਰ ਸੱਤ 'ਤੇ ਉਹਦੇ ਵਿੱਚ ਅੱਗੇ ਕਿੱਥੇ ਕੁ ਜਾਣਾ ਆਪਾਂ ਮੈਂ ਸੋਚ ਰਿਹਾ ਸੀ ਆਫਲਾਈਨ ਜ਼ਿਆਦਾ ਬੈਟਰ ਹੋਵੇਗਾ ਕਿਉਂਕਿ ਪਰਸਨਲ ਇੰਟਰੈਕਸ਼ਨ ਗੁੱਡ ਹੋ ਜਾਏਗੀ ਨਾ ਉਹਦੇ ਵਿੱਚ ਵਧੀਆ ਬਣ ਜਾਏਗੀ ਤਾਂ ਉਹ ਸਹੀ ਰਹੂੰਗਾ ਮੇਰੇ ਖਿਆਲ ਨਾਲ ਬਾਕੀ ਤੁਸੀਂ ਰਿਕਮੈਂਡ ਕਰ ਦਿਓ ਕਿੱਦਾਂ ਕਰ ਸਕਦੇ ਆ ਹੈ ਨਾ ਅਤੇ ਸਰ ਟਾਈਮਿੰਗ ਕੀ ਹੋਵੇਗੀ ਜਿਵੇਂ ਆਪਾਂ ਆਫਲਾਈਨ ਲਗਾਉਣਾ ਨਾ ਅਤੇ ਟਾਈਮ ਕੀ ਰੱਖੀਏ ਛੇ ਤੋਂ ਅੱਠ ਚਲੋ ਹਾਂਜੀ ਹਾਂਜੀ ਹਾਂਜੀ ਠੀਕ ਆ ਜੀ ਮੈਂ ਇੱਕ ਵਾਰੀ ਵਿਜਿਟ ਜ਼ਰੂਰ ਕਰਾਂਗਾ ਹੈ ਨਾ ਠੀਕ ਹੈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ